ਖੁੱਲ੍ਹੇ ਪਾਣੀ ਵਿੱਚ ਤੈਰਾਕੀ ਕਰਦੇ ਸਮੇਂ ਹਮੇਸ਼ਾਂ ਸੁਰੱਖਿਆ ਦਾ ਧਿਆਨ ਰੱਖਣਾ ਚਾਹੀਦਾ ਅਗਰ ਤੁਹਾਨੂੰ ਤੈਰਾਕੀ ਦੇ ਵਿੱਚ ਪੂਰੀ ਮੁਹਾਰਤ ਹਾਸਲ ਹੈ ਤਾਂ ਹੀ ਖੁੱਲ੍ਹੇ ਪਾਣੀ ਦੇ ਵਿੱਚ ਤੈਰਾਕੀ ਕਰਨੀ ਚਾਹੀਦੀ ਹੈ ਅਗਰ ਤੁਸੀਂ ਥੋੜ੍ਹੇ ਬਹੁਤ ਅਣਜਾਣ ਹੋ ਤਾਂ ਕਿਸੇ ਦੀ ਨਿਗਰਾਨੀ ਵਿੱਚ ਤੈਰਾਕੀ ਕਰਨੀ ਚਾਹੀਦੀ ਹੈ ਅਤੇ ਮਤਲਬ ਤਿਲਕਣ ਵਾਲੀਆਂ ਚੱਟਾਨਾਂ ਜਾਂ ਤੇਜ਼ ਵਹਾਅ ਦੇ ਕਾਰਨ ਕੁਝ ਰੁਕਾਵਟਾਂ ਅਤੇ ਸਮੱਸਿਆਵਾਂ ਆ ਸਕਦੀਆਂ ਨੇ ਇਸ ਲਈ ਹਮੇਸ਼ਾਂ ਧਿਆਨ ਦੇ ਨਾਲ ਨਿਗਰਾਨੀ ਦੇ ਵਿੱਚ ਅਤੇ ਆਪਣੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤੈਰਾਕੀ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ